ਸਤਿ ਸ਼੍ਰੀ ਅਕਾਲ ਸਰ ਮੈਂ ਦੇਸਰਾਏ ਬੋਲਦਾ ਹੂੰ ਪਿੰਡ ਪੋਚਕ ਢੇਸੀਆਂ ਦਾ ਰਹਿਣ ਵਾਲਾ ਹਾਂ ਇਹਨਾਂ ਪੰਛੀਆਂ ਨੂੰ ਰੱਖਣ ਲਈ ਸਾਡੇ ਸੁਝਾਅ ਆਕਰਸ਼ਿਤ ਕਰਨ ਲਈ ਸਾਡੇ ਘਰ ਵਿੱਚ ਚੋਗਾ ਚੁਗਣ ਲਈ ਪੰਛੀ ਆਉਂਦੇ ਨਾ ਅਸੀਂ ਆਪਣੇ ਘਰ ਦੇ ਆਲੇ ਦੁਆਲੇ ਗਮਲੇ ਰੱਖਣੇ ਹੈ ਉਨ੍ਹਾਂ ਦੇ ਵਿੱਚ ਪੰਛੀ ਚੋਗਾ ਚੁਗਣ ਲਈ ਆਉਂਦੇ ਹੈ ਅਸੀਂ ਉਹਨਾਂ ਪੰਛੀਆਂ ਨੂੰ ਚੋਗਾ ਚੁਗ ਕੇ ਉਹਨਾਂ ਦਾ ਉਹਨਾਂ ਨੂੰ ਪਾਣੀ ਵੀ ਗਮਲੇ ਵਿੱਚ ਹੀ ਪਾ ਕੇ ਰੱਖਦੇ ਹੈ ਕਿਉਂ ਉਹ ਪੰਛੀ ਪਾਣੀ ਚੋਗਾ ਚੁਗ ਕੇ ਪਾਣੀ ਪੀ ਸਕਣ ਇਹਨਾਂ ਪੰਛੀਆਂ ਨੂੰ ਇੱਕ ਅਨਾਜ ਵੀ ਦੇਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਹਨਾਂ ਪੰਛੀਆਂ ਨੂੰ ਰਹਿਣ ਔਰ ਘੁੰਮਣ ਫਿਰਨ ਦਾ ਬਹੁਤ ਹੀ ਇਸ ਆਲਾ ਦੁਆਲਾ ਪਸੰਦ ਲੱਗੇ ਆਪਣੇ ਘਰ ਦੇ ਵਿੱਚ ਖਿੜਕੀਆਂ ਔਰ ਬਾਰੀਆਂ ਵੁਰੀਆਂ ਦੀ ਸਫਾਈ ਹੋਣੀ ਚਾਹੀਦੀ ਹੈ ਕਿਉਂ ਇਹ ਪੰਛੀ ਆਪਾਂ ਨੇ ਆਪਣੇ ਘਰ ਆਲ੍ਹਣਾ ਵੀ ਬਣਾ ਸਕਣ ਪੰਛੀਆਂ ਨੂੰ ਆਕਰਸ਼ਿਤ ਕਰਨ ਦਾ ਬਹੁਤ ਹੀ ਜ਼ਰੂਰੀ ਹੈ ਇਹ ਪੰਛ